ਸਾਡੇ ਸੱਭਿਆਚਾਰ ਵਿੱਚ ਮਾਹਵਾਰੀ ਦਾ ਇਲਾਜ ਡੋਕਟਰਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਟੀਮਾਂ ਆਉਂਦੀਆਂ ਰਹਿੰਦੀਆਂ ਹਨ ਜੋ ਕਿ ਮਾਹਵਾਰੀ ਬਾਰੇ ਔਰਤਾਂ ਨੂੰ ਜਾਗਰੂਕ ਕਰਦੀਆਂ ਹਨ ਕਿ ਕਿਵੇਂ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖਣਾ ਹੈ ਖਾਣ ਪੀਣ ਦਾ ਧਿਆਨ ਰੱਖਣਾ ਹੈ ਅਤੇ ਆਪਣੀ ਸਰੀਰਕ ਸਵੱਛਤਾ ਰੱਖਣੀ ਹੈ ਸਰੀਰ ਨੂੰ ਸਾਫ ਰੱਖਣਾ ਹੈ ਉਹਨਾਂ ਬਾਰੇ ਉਹ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਪਹਿਲਾਂ ਟਾਈਮ ਕੁਛ ਐਵੇਂ ਦਾ ਸੀ ਕਿ ਔਰਤਾਂ ਨੂੰ ਇਸ ਚੀਜ਼ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਸੀ ਪਰ ਅੱਜ ਕੱਲ ਡੋਕਟਰਾਂ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਜਾਣਕਾਰੀ ਨੂੰ ਉਹ ਅਪਣਾਉਂਦੀਆਂ ਹਨ ਅਤੇ ਆਪਣਾ ਧਿਆਨ ਰੱਖਦੀਆਂ ਹਨ ਜੇ ਕੋਈ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਆਪਣਾ ਇਲਾਜ ਵੀ ਕਰਵਾਉਂਦੀਆਂ ਹਨ ਅਤੇ ਹਰ ਇੱਕ ਚੀਜ਼ ਇੱਥੇ ਸਰਕਾਰੀ ਡਿਸਪੈਂਸਰੀ ਵਿੱਚ ਉਪਲਬਧ ਹੈ ਅਤੇ ਉਹ ਉੱਥੇ ਜਾ ਕੇ ਵੀ ਆਪਣੀ ਸਮੱਸਿਆਵਾਂ ਹੱਲ ਕਰਵਾਉਂਦੀਆਂ ਹਨ